ਮੈਂ ਰੈਸਪੀ ਬੇਸਣ ਦੀ ਬਰਫ਼ੀ ਬਾਰੇ ਆਪਣਾ ਤਜਰਬਾ ਦੱਸਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਘਿਓ ਗਰਮ ਕਰਨ ਕਰਨਾ ਹੈ ਫਿਰ ਬੇਸਣ ਇਸ ਵਿੱਚ ਮੈਂ ਬੇਸਣ ਭੁੰਨਿਆ ਬੇਸਣ ਜਿਹੜਾ ਮੇਰੇ ਤੋਂ ਸ ਸੜ ਗਿਆ ਬੇਸਣ ਦਾ ਕਲਰ ਵੀ ਬਦਲ ਗਿਆ ਉਸ ਵਿੱਚੋਂ ਸਮੈਲ ਵੀ ਆਉਣ ਲੱਗ ਪਈ ਉਸ ਨੂੰ ਸਹੀ ਕਰਨ ਲਈ ਮੈਂ ਇਲਾਇਚੀ ਪਾਊਡਰ ਪਾਇਆ ਸੌਂਫ ਅਜਵਾਇਣ ਵੀ ਪਾਈ ਇਸ ਤੋਂ ਬਾਅਦ ਬਦਾਮ ਦੀਆਂ ਗਿਰੀਆਂ ਨਾਰੀਅਲ ਅਤੇ ਬੁਰਾਦਾ ਵੀ ਪਾਇਆ ਉਸ ਦੇ ਵਿੱਚ ਖੋਇਆ ਵੀ ਪਾਇਆ ਘਿਓ ਦੀ ਮਾਤਰਾ ਵੀ ਘਟ ਗਈ ਫਿਰ ਉਸ ਵਿੱਚ ਘਿਓ ਪਾਇਆ ਕਲ ਕਲਰ ਵੀ ਠੀਕ ਹੋ ਗਿਆ ਸਵਾਦ ਵੀ ਠੀਕ ਹੋ ਗਿਆ ਬੇਸਣ ਹੁਣ ਤਿਆਰ ਹੋ ਗਿਆ ਫਿਰ ਮੈਂ ਆਪਣੇ ਘਰਦਿਆਂ ਨੂੰ ਖਵਾਇਆ ਘਰਦਿਆਂ ਨੇ ਬੜੀ ਤਾਰੀਫ਼ ਕੀਤੀ ਇਸ ਤਰ੍ਹਾਂ ਮੇਰਾ ਮਾਣ ਸਨਮਾਨ ਵੀ ਵਧ ਗਿਆ ਮੈਂ ਰੈਸਪੀ ਵਧਾਉਣ ਦਾ ਬਹੁਤ ਰੈਸਪੀ ਬਣਾਉਣ ਦਾ ਬਹੁਤ ਵਧੀਆ ਤਜਰਬਾ ਰਿਹਾ